ਕਸਰਤ ਆਪਾਂ ਚੱਲ ਫਿਰ ਕੇ ਕਰਦੇ ਹਾਂ ਜਿਵੇਂ ਚੱਲਣਾ ਫਿਰਨਾ ਜਾਂ ਆਪਾਂ ਕਿਤੇ ਖੜ੍ਹੇ ਹੋ ਕੇ ਤੁਰ ਫਿਰ ਕੇ ਆਪਾਂ ਕਸਰਤ ਕਰ ਸਕਦੇ ਹਾਂ ਅ ਯੋਗਾ ਯੋਗਾ ਆਪਾਂ ਇੱਕ ਹੀ ਜਗ੍ਹਾ ਦੇ ਵਿੱਚ ਕਿੱਥੇ ਬੈਠ ਕੇ ਕਰ ਸਕਦੇ ਹਾਂ ਕਮਰੇ ਵਿੱਚ ਹੋਲ ਵਿੱਚ ਛੱਤ 'ਤੇ ਬੈਠ ਕੇ ਕਰ ਸਕਦੇ ਹਾਂ ਸਿਰਫ ਕਸਰਤ ਹੀ ਆਪਾਂ ਗਰਾਊਂਡ 'ਚ ਰੋਡ 'ਤੇ ਚੱਲ ਫਿਰ ਕੇ ਆਦਿ ਖੁੱਲ੍ਹੀ ਜਗ੍ਹਾ 'ਤੇ ਕਰ ਸਕਦੇ ਹਾਂ ਯੋਗ ਨੂੰ ਕਰਨ ਵਾਸਤੇ ਕੋਈ ਜ਼ਿਆਦਾ ਖੁੱਲ੍ਹੀ ਜਗ੍ਹਾ ਦੀ ਜ਼ਰੂਰਤ ਨਹੀਂ ਪੈਂਦੀ ਇਹ ਆਪਾਂ ਇੱਕ ਹੀ ਜਗ੍ਹਾ 'ਤੇ ਬੈਠ ਕੇ ਆਰਾਮ ਨਾਲ ਕਰ ਸਕਦੇ ਹਾਂ ਯੋਗ ਅਤੇ ਕਸਰਤ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ